ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਸਟੈਂਡ ਅਪ ਕੋਮੇਡੀ ਸ਼ੋ ਦਾ ਸੱਦਾ ਦਿੱਤਾ ਹੈ ਮੈਨੂੰ ਕਮੇਡੀ ਸ਼ੋ ਬਹੁਤ ਚੰਗੇ ਲੱਗਦੇ ਹਨ ਕਿਉਂਕਿ ਇਹ ਮਨੁੱਖ ਦਾ ਮਨੋਰੰਜਨ ਕਰਦੇ ਹਨ ਅੱਜ ਦਾ ਮਨੁੱਖ ਸਮੱਸਿਆ ਵਿੱਚ ਘਿਰਿਆ ਰਹਿੰਦਾ ਹੈ ਇਹ ਮਨੁੱਖ ਦੇ ਮਾਨਸਿਕ ਭਾਰ ਨੂੰ ਹੌਲਾ ਕਰਨ ਲਈ ਸਹਾਇਕ ਹਨ ਮੈਂ ਬਿਨਾਂ ਕਿਸੀ ਟਕਰਾਅ ਦੇ ਹਿੱਸਾ ਲੈ ਸਕਦੀ ਹਾਂ ਮੈਨੂੰ ਸੂਚਿਤ ਕੀਤਾ ਜਾਵੇ ਇਹ ਕੋਮੇਡੀ ਸ਼ੋ ਕਿਹੜੀ ਮਿਤੀ 'ਤੇ ਕਿਸ ਸਥਾਨ 'ਤੇ ਹੈ ਇਸ ਬਾਰੇ ਦੱਸਿਆ ਜਾਵੇ ਤਾਂ ਕਿ ਮੈਂ ਇਸ ਵਿੱਚ ਹਿੱਸਾ ਲੈ ਸਕਾਂ